ਚੁਣੌਤੀਪੂਰਨ ਵਿਅੰਜਨ ਜੀਵਨ ਹੀ ਹੈ ਜਿਸ ਨੂੰ ਕੋਈ ਸਮਝ ਨਹੀਂ ਪਾਇਆ ਮਨਿ ਜੀਤੈ ਜਗੁ ਜੀਤੁ ਸਿੰਪਲ ਇੱਕ ਇੱਕ ਕਹਿਣਾ ਜਿਹਨੂੰ ਕਹਿੰਦੇ ਆ ਜੀ ਗੁਰਬਾਣੀ ਦਾ ਕਹਾਣ ਹੈ ਮਨਿ ਜੀਤੈ ਜਗੁ ਜੀਤੁ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹ ਸਾਰੀ ਦੁਨੀਆਂ ਨੂੰ ਜਿੱਤ ਸਕਦਾ ਹੈ ਇਹੀ ਸਾਡਾ ਇੱਕ ਵਿਅੰਜਨ ਹੈ ਇਹੀ ਕੋਸ਼ਿਸ਼ ਹੈ ਸਾਰੀ ਦੁਨੀਆਂ ਪਹਿਲਾਂ ਵੀ ਕਰਦੀ ਆ ਰਹੀ ਸੀ ਹੁਣ ਵੀ ਕਰਦੀ ਆ ਰਹੀ ਹੈ ਕਿ ਅਸੀਂ ਆਪਣੇ ਆਪ ਨੂੰ ਸਰਬ ਪਰਾ ਸਰਬ ਕਲੰਕ ਭਰਪੂਰ ਕਰੀਏ ਪਰ ਓਹ ਨਹੀਂ ਹੋ ਸਕਦਾ